ਮੈਂ ਸ਼ਹਿਰ ਗਿੱਦੜਬਾਹਾ ਦਾ ਵਸਨੀਕ ਹਾਂ ਸਾਡੇ ਇਲਾਕੇ ਵਿੱਚ ਕਬਜ਼ ਦੀ ਕਾਫ਼ੀ ਸਮੱਸਿਆ ਜੇਕਰ ਆਉਂਦੀ ਹੈ ਤਾਂ ਉਸ ਲਈ ਘਰੇਲੂ ਨੁਸਖੇ ਨੂੰ ਪਹਿਲ ਦੇ ਆਧਾਰ 'ਤੇ ਵਰਤੇ ਜਾਂਦੇ ਜਿਵੇਂ ਕਿ ਸਭ ਤੋਂ ਪਹਿਲਾਂ ਵਰਤਿਆ ਜਾਂਦਾ ਹੈ ਵੀ ਸਵੇਰੇ ਖਾਲੀ ਪੇਟ ਗਰਮ ਗਲਾਸ ਦੁੱਧ ਲੈ ਕੇ ਵਿੱਚ ਨਿੰਬੂ ਨਿਚੋੜ ਕੇ ਉਸ ਦਾ ਸੇਵਨ ਇੱਕ ਵਾਰ ਵਿਚ ਕਰਨ ਨਾਲ ਆਪਣੀ ਜਿਹੜੀ ਇਹ ਸਮੱਸਿਆ ਕਬਜ਼ ਦੀ ਇਹ ਦੂਰ ਹੁੰਦੀ ਹੈ ਇਸ ਇਹ ਨੁਸਖੇ ਅਸੀਂ ਕਿਸੇ ਹੋਰ ਜਗ੍ਹਾ 'ਤੇ ਵੀ ਬਹੁਤ ਥਾਵਾਂ 'ਤੇ ਵਰਤੇ ਅਤੇ ਇਸ ਨਾਲ ਬਹੁਤ ਹੀ ਆਰਾਮ ਵੀ ਲੋਕਾਂ ਨੂੰ ਮਿਲਿਆ ਹੈ ਦੂਸਰਾ ਇਲਾਜ ਹੈ ਕੌੜ ਤੁੰਮੇ ਦਾ ਚੂਰਨ ਇਸ ਨੂੰ ਘਰ ਆਮ ਤੌਰ 'ਤੇ ਤਿਆਰ ਕੀਤਾ ਜਾਂਦਾ ਹੈ ਇਸ ਨੂੰ ਸਵੇਰੇ ਖਾਲੀ ਪੇਟ ਗਰਮ ਨਾਲ ਲੈਣ ਨਾਲ ਵੀ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ ਅਤੇ ਪੁਰਾਣੀ ਤੋਂ ਪੁਰਾਣੀ ਕਬਜ਼ ਵੀ ਦੂਰ ਹੁੰਦੀ ਹੈ ਹੋਰ ਵੀ ਜਿਵੇਂ ਕਈ ਪ੍ਰਕਾਰ ਦੇ ਚੂਰਨ ਜਿਵੇਂ ਕਿ ਅਜਵਾਇਣ ਸੌਂਫ ਹਰੜਾ ਤ੍ਰਿਫਲਾ ਔਲੇ ਇਹਨਾਂ ਨੂੰ ਇੱਕ ਪੀਸ ਕੇ ਵੀ ਇੱਕ ਚੂਰਨ ਤਿਆਰ ਹੁੰਦਾ ਹੈ ਜਿਸ ਦਾ ਸੇਵਨ ਰੋਜ਼ ਹੀ ਸੁਬਾਹ ਚੁੰਡੀ ਹੱਥ 'ਤੇ ਰੱਖ ਕੇ ਗਰਮ ਪਾਣੀ ਨਾਲ ਲੈਣ ਨਾਲ ਵੀ ਉਸ ਦੀ ਸਮੱਸਿਆ ਹੈ ਜਿਹੜੀ ਉਹ ਪੂਰਨ ਤੌਰ 'ਤੇ ਖਤਮ ਹੁੰਦੀ ਹੈ ਹੋਰ ਵੀ ਜਿਵੇਂ ਹੋਰ ਸ਼ਾਮ ਨੂੰ ਸੌਣ ਲੱਗੇ ਇੱਕ ਗਰਮ ਗਿਲਾਸ ਦੁੱਧ ਕਰ ਲੈਣਾ ਅੱਧੇ ਤੋਂ ਥੋੜ੍ਹਾ ਜਿਹਾ ਜ਼ਿਆਦਾ ਉਸਦੇ ਵਿੱਚ ਤੁਸੀਂ ਤੇਜ਼ ਮਿੱਠਾ ਜਿਹੜਾ ਹੈ ਆਪਾਂ ਪਾ ਦੇਣਾ ਉਸ ਨੂੰ ਸੌਣ ਵੇਲੇ ਪੂਰਨ ਤੌਰ 'ਤੇ ਉਹਨੂੰ ਲੈ ਲੈਣਾ ਅਤੇ ਉਸ ਤੋਂ ਬਾਅਦ ਸਵੇਰੇ ਉੱਠ ਕੇ ਗਰਮ ਪਾਣੀ ਦਾ ਸੇਵਨ ਜ਼ਰੂਰ ਕਰਨਾ ਉਸ ਨਾਲ ਵੀ ਜਿਹੜੀ ਕਬਜ਼ ਦੀ ਸਮੱਸਿਆ ਹੈ ਇਹ ਪੂਰਨ ਤੌਰ 'ਤੇ ਖਤਮ ਹੋ ਜਾਂਦੀ ਹੈ ਅਤੇ ਕਈ ਲੋਕਾਂ ਨੂੰ ਇਸ ਸਮੱਸਿਆ ਤੋਂ ਰਾਹਤ ਮਿਲੀ ਹੈ